ਭਾਅ ਜੀ ਅਸੀਂ ਕਿੱਥੇ ਪਹੁੰਚ ਗਏ ਜੀ ਮੈਨੂੰ ਲੱਗਦਾ ਅਜੇ ਚੰਡੀਗੜ੍ਹ ਹੀ ਘੁੰ ਫਿਰਦੇ ਅਸੀਂ ਆਹ ਰਸਤਾ ਨਵਾਂ ਬਣਨ ਲੱਗਿਆ ਇਹਦੇ ਪਰ ਹੀ ਚਲਦੇ ਅਸੀਂ ਮਤਲਬ ਜਿਹੜਾ ਪੁਰਾਣਾ ਰਸਤਾ ਸੀ ਉਹ ਬੰਦ ਹੋ ਗਿਆ ਸੀ ਨਵਾਂ ਰਸਤਾ ਚਾਲੂ ਹੋਇਆ ਤਾਂ ਫਿਰ ਸਾਨੂੰ ਪਿੱਛੇ ਘੁੰਮ ਕੇ ਜਾਣਾ ਪਿਆ ਨਾ ਫਿਰ ਅਸੀਂ ਲੇਟ ਹੋ ਗਏ ਭਾਅ ਜੀ ਮੈਨੂੰ ਛੇਤੀ ਪਹੁੰਚਾ ਦਿਓ ਜੀ ਮੈਨੂੰ ਬਹੁਤ ਜ਼ਰੂਰੀ ਕੰਮ ਹੈ ਤੁਸੀਂ ਬਹੁਤ ਵਧੀਆ ਡਰਾਈਵਰ ਆ ਤੁਸੀਂ ਮਾਸਕ ਵਗੈਰਾ ਸਾਰਾ ਲਾਇਆ ਹੋਇਆ ਅਤੇ ਤੁਸੀਂ ਡਰਾਈਵਿੰਗ ਬਹੁਤ ਵਧੀਆ ਕਰਦੇ ਹੈ ਭਾਅ ਜੀ ਥੋੜ੍ਹਾ ਗਾਣੇ ਵਗੈਰਾ ਵੀ ਲਾ ਦਿਓ ਅਤੇ ਭਾਅ ਜੀ ਨਵਾਂਸ਼ਹਿਰ ਦੇ ਪਿੱਛੇ ਥੋੜ੍ਹਾ ਰੋਕ ਦਿਓ ਢਾਬਾ ਹੈ ਮੈਂ ਉੱਥੇ ਰੋਟੀ ਵੀ ਖਾਣੀ ਹੈ ਭੁੱਖ ਲੱਗੀ ਹੈ ਅਤੇ ਭਾਅ ਜੀ ਮੈਨੂੰ ਛੇਤੀ ਤੋਂ ਛੇਤੀ ਪਹੁੰਚਾ ਦਿਓ ਮੈਨੂੰ ਲੱਗਦਾ ਹੈ ਕਿ ਮੈਨੂੰ ਮੈਂ ਤਾਂ ਪਹਿਲਾਂ ਹੀ ਲੇਟ ਹਾਂ ਬਹੁਤ ਜ਼ਿਆਦਾ ਹੁਣ ਬਹੁਤ ਹੀ ਜ਼ਿਆਦਾ ਜ਼ਰੂਰੀ ਕੰਮ ਹੈ ਠੀਕ ਹੈ ਭਾਅ ਜੀ ਥੈਂਕ ਯੂ